ਪੌਦੇ ਉਗਾਉਣ ਲਈ ਅ ਅਸੀਂ ਖੇਤ ਵਾਲੀ ਮਿੱਟੀ ਦੀ ਵਰਤੋਂ ਕਰਦੇ ਹਾਂ ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਦੀ ਵੀ ਵਰਤੋਂ ਕਰਦੇ ਹਾਂ ਅਤੇ ਖਾਦ ਦੇ ਤੌਰ 'ਤੇ ਵਰਤਣ ਲਈ ਅਸੀਂ ਜਿਹੜੀ ਪਸ਼ੂਆਂ ਦੀ ਰਹਿੰਦ ਖੂੰਹਦ ਹੁੰਦੀ ਹੈ ਉਹ ਵਰਤਦੇ ਹਾਂ ਉਹ ਪੌਦਿਆਂ ਲਈ ਬਹੁਤ ਹੀ ਵਧੀਆ ਕਿਸਮ ਦੀ ਇੱਕ ਖਾਦ ਹੁੰਦੀ ਹੈ